ਹਾਂ ਸਾਡੇ ਹਾਂ ਸਾਡੇ ਇਲਾਕੇ ਦੇ ਬੱਚੇ ਰਾਸ਼ਟਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਿੰਦੇ ਹਨ ਇੰਡੀਆਸਕਿੱਲਸ ਮੁਕਾਬਲਿਆਂ ਦੇ ਉਦੇਸ਼ ਹੁਨਰ ਦੇ ਮੰਚਾਂ ਦੇ ਮੰਚਾਂ ਦਾ ਪ੍ਰਦਰਸ਼ਨ ਕਰਨਾ ਹੈ ਅਤੇ ਜੁਆਵਾਂ ਨੂੰ ਰਾਸ਼ਟਰੀ ਪੱਧਰ 'ਤੇ ਆਪਣੇ ਪ੍ਰਤਿਭਾ ਪ੍ਰਦਰਸ਼ਨ ਲਈ ਪ੍ਰਦਾਨ ਕਰਦਾ ਹੈ ਭਾਰਤੀ ਪ੍ਰਤਿਭਾ ਓ ਓਲੰਪਿਆਡ ਨੇ ਰਾਸ਼ਟਰੀ ਕਿਡਰਨ ਨਾ ਕਿਡਰਨ ਕਾਰਡਨ ਗਾਰਡਨ ਓਲੰਪਿਕ ਓਲੰਪਿਆਡ ਦੀ ਸ਼ੁਰੂਆਤ ਕਰਕੇ ਬੱਚਿਆਂ ਲਈ ਕਿਡਨਗਾਰਡਨ ਲਈ ਇੱਕ ਨਵਾਂ ਰਾਹ ਖੋਲ੍ਹਿਆ ਹੈ ਓਲੰਪੀਆਡ ਇਸ ਓਲੰਪੀਆਡ ਵਿੱਚ ਆਈਟੀਓ ਜੂਨੀਅਰ ਕੇਜੀ ਅਤੇ ਸੀਨੀਅਰ ਕੇਜੀ ਵਿੱਚ ਪੜ੍ਹ ਰਹੇ ਬੱਚੇ ਛੋਟੇ ਬੱਚੇ ਲਈ ਬੱਚਿਆਂ ਲਈ ਨੈਸ਼ਨਲ ਇੰਡੀਕਾ ਕਿ ਕਿਡਰਗਾਰਡਨ ਡਰਾਇੰਗ ਓਲੰਪੀਆਰ ਅਤੇ ਨੈਸ਼ਨਲ ਕਿਡਰ ਚਿਲਡਰਨ ਗਾਰਡਨ ਹੈਂਡਰਾਈਟਿੰਗ ਓਲੰਪੀਆਡ ਦਾ ਆਯੋਜਨ ਕਰ ਰਹੇ ਹਨ ਇੱਕ ਸੰਸਥਾ ਖੋਲ੍ਹੀ ਹੈ ਜਿਸਦਾ ਨਾਮ ਨੈਸ਼ਨਲ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਹੈ ਜਿਸ ਵਿੱਚ ਬਹੁਤ ਸਾਰੀਆਂ ਸਹੂਲਤਾਵਾਂ ਹਨ ਖੇਡਾਂ ਦਾ ਸਮਾਨ ਹੁੰਦਾ ਹੈ ਅਤੇ ਖਿਡਾਰੀਆਂ ਲਈ ਬਹੁਤ ਸਾਰਾ ਪ੍ਰਬੰਧ ਹੁੰਦਾ ਹੈ